ਹੈਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਚਲਿਆ ਕਰਦੀ ਭਾਅ ਜੀ ਚੰਗਾ ਚੰਗੀ ਫ਼ਸਲ ਹੋ ਰਹੀ ਹੈ ਚੰਗੀ ਐੱਮ ਐੱਸ ਪੀ ਮਿਲਿਆ ਕਰਦੀ ਹੈ ਅੱਛਾ ਅੱਛਾ ਅੱਛਾ ਅੱਛਾ ਅੱਛਾ ਅਤੇ ਉਪਜਾਊ ਉਪਜਾਊ ਚੰਗੀ ਰਹੀ ਜੀ ਜਾਂ ਕੋਈ ਘਾਟਾ ਨਾ ਹੋ ਜੇ ਜਾਂ ਖ਼ਰਾਬ ਨਾ ਹੋ ਜੇ ਫ਼ਸਲ

ਹਾਂਜੀ ਹਾਂਜੀ ਹਾਂਜੀ ਬਹੁਤ ਚੰਗੀ ਸਕੀਮ ਆ ਭਾਅ ਜੀ ਚਲੋ ਦੇਖਦੇ ਹਾਂ ਕਰਦੇ ਹਾਂ ਅੱਗੇ ਓਕੇ ਓਕੇ ਜੀ ਬਾਏ